ਹਾਂਜੀ ਕੀ ਹਾਲ ਚਾਲ ਤੁਹਾਡਾ ਵਧੀਆ ਵਧੀਆ ਹੋਰ ਕੀ ਕਰਦੇ ਅੱਜ ਕੱਲ੍ਹ ਹੋਰ ਤੁਹਾਡਾ ਮੁੰਡਾ ਗੋਬਿੰਦ ਕੀ ਕਰ ਰਿਹਾ ਹਾਂ ਮੇਰਾ ਮੁੰਡਾ ਵੀ ਇਹ ਹੀ ਸੋਚ ਰਿਹਾ ਆਪਾਂ ਕਿੱਥੇ ਪਾਈਏ ਪਲਸ ਵਨ ਪਲਸ ਟੂ 'ਚ ਹਾਂਜੀ ਉਹ ਮਾਊਂਟ ਕਰਮਲ ਆਈ ਸੀ ਐਸ ਈ ਆ ਵੈਸੇ ਤਾਂ ਉਹਨੇ ਕਰਨਾ ਕੀ ਆ ਵੈਸੇ ਨਾਨ ਮੈਡੀਕਲ ਹਾਂ ਮੈਂ ਵੀ ਇਸ ਤੋਂ ਪੁੱਛਿਆ ਸੀ ਕਹਿੰਦਾ ਕਮਰਸ ਕਰਨੀ ਆ ਨੋਨ ਮੈਡੀਕਲ ਮੈਡੀਕਲ ਸੋਚਦੇ ਹਾਂ ਸਕੂਲ ਵੀ ਵਧੀਆ ਨਹੀਂ ਹੈਗੇ ਕੋਈ ਅੱਜ ਕੱਲ੍ਹ ਹਾਂ ਸਕੂਲ ਤਾਂ ਦੇਖਣੇ ਪੈਣੇ ਆ ਤੁਸੀਂ ਕੁਛ ਕਹਿਣਾ ਸੀ ਕੋਈ ਸਕੂਲ ਤੁਸੀਂ ਕੋਈ ਸਕੂਲ ਪੁੱਛ ਕੇ ਆਏ ਹੋ ਵੈਸੇ ਜੈਨ ਹਾਂ ਜੈਨ ਡ ਬਸ ਸੀ ਬੀ ਐੱਸ ਈ ਹੋਣ ਲੱਗਾ ਇਸ ਵਾਰ ਨਾ

ਮੈਂ ਵੀ ਗਿਆ ਸੀ ਡੀ ਏ ਵੀ ਪੁੱਛਣ ਡੀ ਏ ਵੀ ਗਿਆ ਸੀ ਮੈਂ ਅਤੇ ਵੀ ਗਿਆ ਸੀ ਚੋਲੀਪੁਰ ਗਿਆ ਸੀ ਡੀ ਏ ਵੀ ਵੀ ਗਿਆ ਸੀ ਉਹਨਾਂ ਨੇ ਦੱਸਿਆ ਠੀਕ ਆ ਵੈਸੇ ਫੀਸ ਫੁਸ ਵੀ ਠੀਕ ਆ ਉੱਥੇ ਸਾਰਾ ਕੁਝ ਠੀਕ ਚਲਦਾ ਫੀਸ ਵੀ ਠੀਕ ਆ ਉੱਥੇ ਹੋਰ ਇਹ ਕਹਿੰਦੇ ਸੀ ਕੋਚਿੰਗ ਅਗ ਅਗਰ ਨੋਨ ਮੈਡੀਕਲ ਕਰਨੀ ਤਾਂ ਕੋਚਿੰਗ ਹੋਇਆ ਵਗੈਰਾ ਵੀ ਜਾ ਸਕਦੇ ਹਾਂ ਤਾਂ ਇਹ ਸੋਚਦੇ ਹਾਂ ਹਾਂ ਹਲੇ ਤਾਂ ਹਲੇ ਤਾਂ ਦੇਖਦੇ ਆ ਉਹ ਡੀ ਏ ਵੀ ਡੀ ਏ ਵੀ ਡੀ ਏ ਵੀ ਵਧੀਆ ਲੱਗਾ ਮੈਨੂੰ ਚੌਧਰੀ ਵੀ ਹਾਂ ਡੀ ਏ ਵੀ ਗਿਆ ਸੀ ਹਾਂਜੀ ਡੀ ਏ ਵੀ ਰੇਟ ਵੀ ਠੀਕ ਆ ਉੱਥੇ ਪਰਿਨਸੀ ਦੇਖਿਆ ਮੈਂ ਸਾਰਾ ਸਟਾਫ ਵੀ ਠੀਕ ਲੱਗ ਰਿਹਾ ਸੀ ਮੈਨੂੰ ਵੈਸੇ ਅਤੇ ਵੈਸੇ ਡੀ ਏ ਵੀ ਡੀ ਏ ਵੀ ਪ ਪੰਜਾਬ ਬੋਰਡ ਹੈ ਨਾ ਤਾਂ ਇਹ ਸੀ ਬੀ ਐਸ ਈ ਮੈਂ ਤਾਂ ਸੀ ਬੀ ਐਸ ਈ ਪਾਉਣ ਦੀ ਸੋਚ ਰਿਹਾਂ ਇਹਨੂੰ ਇਸ ਵਾਰ ਤਾਂ ਤੁਸੀਂ ਕੀ ਕੇ ਕੇ ਕੀ ਪਾਉਣ ਦੀ ਸੋਚ ਰਹੇ ਸੀ ਬੀ ਐਸ ਈ ਜਾਂ ਪੰਜਾਬ ਬੋਰਡ 'ਚ ਸੀ ਬੀ ਐਸ ਈ ਹਾਂ ਸੀ ਬੀ ਐਸ ਈ ਤਾਂ ਹੈ ਹੀ ਇੱਕ ਸੀ ਬੀ ਐਸ ਈ ਚੌਧਰੀ ਆ ਬਾਕੀ ਤਾਂ ਕੋਚਿੰਗ ਸੈਂਟਰ 'ਚ ਸੀ ਬੀ ਐਸ ਈ ਮਿਲੂਗਾ ਇਹਨੂੰ ਮਾਉਂਟ ਕਾਰਮਲ ਤਾਂ ਆਈ ਸੀ ਐਸ ਈ ਆ ਹਾਂ ਸੀ ਬੀ ਐਸ ਈ ਹਾਂ ਹਾਂ ਹਾਂ ਕੈਂਡਲ ਬੋਰਡ ਹਾਂ ਇੱਕ ਹੈਗਾ ਪੰਜਾਬ ਬੋਰਡ ਸੂਟ ਨਹੀਂ ਕਰਨਾ ਇਹਨੂੰ ਪੰਜਾਬ ਬੋਰਡ ਸੂਟ ਨਹੀਂ ਕਰਨਾ ਹੋਰ ਹੋਰ ਦੇਖਦੇ ਹਾਂ ਜੋ ਤੁਸ ਤੁਸੀਂ ਵੀ ਦੇਖੋ ਕਿਹੜੇ ਕਿਹੜੇ ਸਕੂਲ ਜਾਓਗੇ ਮੈਂ ਵੀ ਜਾ ਆਉਣਾ ਦੇਖ ਕੇ ਕਰਦੇ ਹਾਂ ਗੱਲ ਇਹ ਹਾਲੇ ਤੁਸੀਂ ਕਿਹੜੇ ਕਿਹੜੇ ਸਕੂਲ ਜਾਣੇ ਆ ਤੁਸੀਂ ਕਿਹੜੇ ਸਕੂਲ ਜਾਓਗੇ ਹਾਂ ਆਈ ਸੀ ਐਸ ਈ ਹਾਂਜੀ ਮੈਂ ਨਾ ਰਿਆਤ ਬਾਹਰਾ ਹਾਂ ਉਹ ਡੀ ਏ ਵੀ ਕਾਲਜ ਵੀ ਹੈਗੀ ਪਲਸ ਵੰਨ ਪਲਸ ਟੂ ਵੈਸੇ ਉੱਥੇ ਵੀ ਜਾ ਕੇ ਪੁੱਛ ਸਕਦੇ ਹਾਂ ਆਪਾਂ ਡੀ ਏ ਵੀ ਕਾਲਜ ਮੈਂ ਗੱਲ ਕੀਤੀ ਸੀ ਉੱਥੇ ਐਸ ਡੀ ਵੀ ਹੈਗੀ ਪਲੱਸ ਵੰਨ ਪਲੱਸ ਟੂ ਤਾਂ ਵੈਸੇ ਤਾਂ ਮੈਂ ਐਸ ਡੀ ਜਾ ਆਉਂਗਾ ਤੁਸੀਂ ਡੀ ਏ ਵੀ ਵੈਸੇ ਬਾਕੀ ਸਕੂਲਾਂ ਨਾਲੋਂ ਤਾਂ ਮੈਨੂੰ ਐਸ ਡੀ ਵੀ ਵਧੀਆ ਲੱਗ ਰਿਹਾ ਸਭ ਤੋਂ ਪਹਿਲੇ ਤਾਂ ਐਸ ਡੀ ਦੀ ਡਿਮਾਂਡ ਬਹੁਤ ਵਧੀ ਆ ਐਸ ਡੀ ਦੀ ਡਿਮਾਂਡ ਬਹੁਤ ਵਧੀਆ ਚੱਲ ਰਹੀ ਆ ਤਾਂ ਐਸ ਡੀ ਵੀ ਤਾਂ ਵੈਸੇ ਕਰ ਸਕਦੇ ਹਾਂ ਜੋ ਐਸ ਡੀ ਮੈਂ ਪੁੱਛਿਆ ਸੀ ਬਾਕੀ ਦੋਸਤਾਂ ਨੂੰ ਮੈਂ ਪਹਿਲੇ ਜਿਹੜੇ ਪੜ੍ਹੇ ਹੋਏ ਆ ਸਾਰਿਆਂ ਤੋਂ ਪੁੱਛਿਆ ਸੀ ਨੌਲੇਜ ਲਈ ਸੀ ਕਹਿੰਦੇ ਸਕੂਲ ਤਾਂ ਠੀਕ ਆ ਵਧੀਆ ਹੋ ਰਿਹਾ ਹੁਣ ਸੀ ਬੀ ਐਸ ਈ ਬੋਰਡ 'ਚ ਕਨਵਰਟ ਹੋ ਰਿਹਾ ਉੱਥੇ ਪਾ ਸਕਦੇ ਸਟਾਫ ਦੀ ਵਧੀਆ ਪੜ੍ਹਾਈ ਵੀ ਠੀਕ ਆ ਉੱਥੇ ਐਕਟੀਵੀਟੀਸ ਵਗੈਰਾ ਵੀ ਕਲਚਰ ਵਗੈਰਾ ਵੀ ਸਾਰਾ ਕੁਝ ਠੀਕ ਠੂਕ ਆ ਉੱਥੇ ਤਾਂ ਐਸ ਡੀ ਜਾ ਰਹੇ ਹਾਂ ਚਲੋ ਦੇਖਦੇ ਹਾਂ ਹਾਂ ਪੜਾਈ ਦਾ ਬਹੁਤ ਵਧੀਆ ਇੱਥੋਂ ਦੀ ਹਾਂ ਇਹ ਮੈਂ ਵੀ ਪੁੱਛਿਆ ਸੀ ਹਾਂ ਚਲੋ ਮੈਂ ਕਰਦਾ ਤੁਹਾਨੂੰ ਐਸ ਡੀ ਜਾ ਕੇ ਪੁੱਛਾਂਗੇ ਮੈਂ ਇੱਕ ਵਾਰ ਮੈਂ ਦੱਸ ਦਊਂਗਾ ਕੀ ਬਣਿਆ ਹਾਂਜੀ ਚਲੋ ਠੀਕ ਹੈ ਕਰਦੇ ਹਾਂ ਗੱਲ ਫਿਰ ਠੀਕ ਹੈ ਜੀ ਬਾਏ ਜੀ ਬਾਏ